ਅਸਲ ਜ਼ਿੰਦਗੀ ਦੀ ਕਹਾਣੀ ਇਹ ਕਿਤਾਬ ਪੜ੍ਹ ਕੇ ਮੈਨੂੰ ਆਪਣੇ ਜੀਵਨ ਦੀ ਕਹਾਣੀ ਯਾਦ ਆ ਗਈ ਇਹ ਕਹਾਣੀ ਮੇਰੀ ਜ਼ਿੰਦਗੀ ਦੀ ਕਹਾਣੀ ਨਾਲ ਰਲਦੀ ਮਿਲਦੀ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਜਿਵੇਂ ਕਿ ਇੱਕ ਗਰੀਬ ਪਰਿਵਾਰ ਦੀ ਕੁੜੀ ਸੜਕ 'ਤੇ ਗੁਬਾਰੇ ਵੇਚਦੀ ਸੀ ਇੱਕ ਦਿਨ ਉਸਦਾ ਕੋਈ ਵੀ ਗੁਬਾਰਾ ਨਹੀਂ ਵਿਕਿਆ ਜਦੋਂ ਉਹ ਘਰ ਗਈ ਤਾਂ ਉਸਦਾ ਸਾਰਾ ਪਰਿਵਾਰ ਮੈਂਬਰ ਉਸਦੇ ਮੂੰਹ ਵੱਲ ਦੇਖ ਰਿਹਾ ਸੀ ਕਿ ਅੱਜ ਪੈਸੇ ਲੈ ਕੇ ਆਈ ਹੋਵੇਗੀ ਅਤੇ ਅਸੀਂ ਖਾਣ ਵਾਸਤੇ ਰੋਟੀ ਪਾਣੀ ਖਰੀਦ ਸਕਾਂਗੇ ਪਰ ਅਫਸੋਸ ਕੇ ਉਸ ਦਾ ਕੋਈ ਉਹ ਗੁਬਾਰਾ ਹੀ ਨਹੀਂ ਵਿਕਿਆ ਸੀ ਇਸ ਲਈ ਕੋਈ ਆਇਆ ਤਾਂ ਉਸਨੂੰ ਪੈਸੇ ਦਿੱਤੇ ਉਹਨੇ ਕਿ ਤੂੰ ਆਪਦਾ ਰਾਸ਼ਨ ਪਾਣੀ ਲੈ ਕੇ ਆ ਅਤੇ ਪਰ ਉਹ ਬਹੁਤ ਹੀ ਇਮਾਨਦਾਰ ਕੁੜੀ ਸੀ ਉਸਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਆਦਮੀ ਨੇ ਕੁੜੀ ਦੀ ਇਮਾਨਦਾਰੀ ਨੂੰ ਦੇਖ ਕੇ ਉਸ ਨੂੰ ਕਿਸੇ ਫੈਕਟਰੀ ਵਿੱਚ ਨੌਕਰੀ ਲਗਵਾ ਦਿੱਤਾ ਅਤੇ ਉਸਦਾ ਘਰ ਦਾ ਗੁਜ਼ਾਰਾ ਬਹੁਤ ਹੀ ਵਧੀਆ ਤਰੀਕੇ ਨਾਲ ਹੋਣ ਲੱਗਾ ਇਹ ਕਹਾਣੀ ਮੇਰੀ ਜ਼ਿੰਦਗੀ ਦੀ ਕਹਾਣੀ ਦੇ ਨਾਲ ਬਿਲਕੁਲ ਮੇਲ ਖਾਂਦੀ ਹੈ